ਮੇਰੇ ਦੌੜਨ ਵਾਲੇ ਜੁੱਤੇ ਅਤੇ ਕੱਪੜੇ ਸਾਨੂੰ ਸਹੂਲਤ ਸਹੀ ਸਮਰਥਨ ਅਤੇ ਮੋਟੀਵੇਸ਼ਨ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਸਹੀ ਦੌੜਨ ਵਾਲੇ ਜੁੱਤੇ ਅਤੇ ਕੱਪੜੇ ਨਾ ਸਿਰਫ ਦੌੜਨ ਦੇ ਤਜ਼ਰਬੇ ਨੂੰ ਬਿਹਤਰ ਬਣਾਉਂਦੇ ਹਨ ਸਗੋਂ ਸੱਟਾਂ ਤੋਂ ਵੀ ਬਚਾਉਂਦੇ ਹਨ ਜਦੋਂ ਮੈਂ ਦੌੜਨ ਲਈ ਜੁੱਤੀਆਂ ਦੀ ਚੋਣ ਕਰਦਾ ਹਾਂ ਤਾਂ ਸਭ ਤੋਂ ਪਹਿਲਾਂ ਸਹੂਲਤ ਅਤੇ ਗਰਿਪ 'ਤੇ ਧਿਆਨ ਦਿੰਦਾ ਹਾਂ ਮੇਰੇ ਜੁੱਤੇ ਕੁਛਨਿੰਗ ਵਾਲੇ ਹੁੰਦੇ ਹਨ ਤਾਂ ਜੋ ਦੌੜਦੇ ਸਮੇਂ ਪੈਰਾਂ 'ਚ ਬਹੁਤ ਜ਼ਿਆਦਾ ਦਬਾਅ ਨਾ ਪਵੇ ਦੌੜਦੇ ਸਮੇਂ ਸਰੀਰ 'ਤੇ ਵੱਧ ਭਾਰ ਪੈਰਾਂ ਦੇ ਤਲਵਿਆਂ 'ਤੇ ਆਉਂਦਾ ਹੈ ਇਸ ਲਈ ਇਹ ਮਹੱਤਵਪੂਰਨ ਹੈ ਕਿ ਜੁੱਤੀਆਂ ਵਿੱਚ ਸਹੀ ਲਗਜ਼ਰੀ ਅਤੇ ਸਮਰਥਨ ਹੋਵੇ ਦੌੜਨ ਦੇ ਜੁੱਤਿਆਂ ਦੀ ਕੁਸ਼ਨਿੰਗ ਮੇਰੇ ਪੈਰਾਂ ਨੂੰ ਚੋਟਾਂ ਤੋਂ ਬਚਾਉਂਦੀ ਹੈ ਖਾਸ ਕਰਕੇ ਜਦੋਂ ਮੈਂ ਸਖਤ ਜਾਂ ਉਬੜ ਖਾਬੜ ਸੜਕਾਂ 'ਤੇ ਦੌੜਦਾ ਹਾਂ ਇਹ ਜੁੱਤੇ ਚੁਸਤ ਹੁੰਦੇ ਹਨ ਪਰ ਪੈਰਾਂ ਨੂੰ ਤੰਗ ਨਹੀਂ ਕਰਦੇ ਇਹਨਾਂ ਦੇ ਹੀ ਸਹੀ ਫਿੱਟ ਮੇਰੇ ਪੈਰਾਂ ਨੂੰ ਠੀਕ ਸਮਰਥਨ ਦਿੰਦੀ ਹੈ ਅਤੇ ਮੈਨੂੰ ਦੌੜਦੇ ਸਮੇਂ ਜ਼ਿਆਦਾ ਆਰਾਮ ਮਹਿਸੂਸ ਹੁੰਦਾ ਹੈ ਦੌੜਨ ਲਈ ਕੱਪੜੇ ਚੁਣਦੇ ਸਮੇਂ ਮੈਨੂੰ ਹਵਾ ਪਸੰਦ ਅਤੇ ਖਿੱਚ ਵਾਲੇ ਕੱਪੜਿਆਂ ਦੀ ਲੋੜ ਹੁੰਦੀ ਹੈ ਸਧਾਰਨ ਕੱਪੜੇ ਜਿਵੇਂ ਕਿ ਕਾਟਨ ਦੌੜਦੇ ਸਮੇਂ ਪਸੀਨਾ ਸੋਖ ਲੈਂਦੇ ਹਨ ਅਤੇ ਕੱਪੜੇ ਭਾਰੀ ਹੋ ਜਾਂਦੇ ਹਨ ਜਿਸ ਨਾਲ ਦੌੜਨ ਦਾ ਤਜ਼ਰਬਾ ਅਸੁਵਿਧਾਜਨਕ ਬਣ ਜਾਂਦਾ ਹੈ ਇਸ ਲਈ ਮੈਂ ਹਮੇਸ਼ਾ ਸਪੋਰਟਸ ਕੱਪੜਿਆਂ ਦੀ ਚੋਣ ਕਰਦਾ ਹਾਂ ਤਾਂ ਜੋ ਪਸੀਨਾ ਸਰੀਰ ਤੋਂ ਦੂਰ ਰਹਿੰਦਾ ਹੈ ਅਤੇ ਮੈਨੂੰ ਸਾਵਧਾਨ ਅਤੇ ਆਰਾਮਦਾਇਕ ਮਹਿਸੂਸ ਕਰਵਾਉਂਦੇ ਹਨ ਮੇਰੀ ਟੀ ਸ਼ਰਟ ਹਮੇਸ਼ਾ ਹਲਕੀ ਹੁੰਦੀ ਹੈ ਮੈਂ ਹਮੇਸ਼ਾ ਤਾਜ਼ਗੀ ਦਾ ਅਨੁਭਵ ਕਰਦਾ ਹਾਂ ਅਤੇ ਸਰੀਰ ਨੂੰ ਠੰਡਾ ਰੱਖਦਾ ਹਾਂ ਖਾਸ ਕਰਕੇ ਗਰਮ ਮੌਸਮ ਵਿੱਚ ਦੌੜਦੇ ਸਮੇਂ ਕਈ ਵਾਰ ਜਦੋਂ ਮੌਸਮ ਠੰਡਾ ਹੁੰਦਾ ਹੈ ਮੈਂ ਲੋਰਿੰਗ ਕਰਦਾ ਹਾਂ ਜਿਵੇਂ ਕਿ ਹਲਕਾ ਜੈਕਟ ਜਾਂ ਸਵੈਟਰਸ਼ਰਟ ਪਹਿਨਦਾ ਹਾਂ ਜੋ ਪਸੀਨਾ ਭਾਵੇਂ ਨਿਕਲਦਾ ਰਹੇ ਪਰ ਮੇਰੇ ਸਰੀਰ ਨੂੰ ਠੰਡ ਤੋਂ ਬਚਾਏ